ਹੈਲੋ ਹਾਂਜੀ ਹਾਂਜੀ ਕੀ ਹਾਲ ਹੈ ਹਾਂ ਠੀਕ ਠਾਕ ਵਧੀਆ ਹਾਂ ਬਸ ਮੈਂ ਕੀਤੀ ਸੀਗੀ ਉਹ ਆਪਣਾ ਹੁਣ ਫਰਦਰ ਕੀ ਕਰਨਾ ਅੱਗੇ ਗ੍ਰੈਜੂਏਸ਼ਨ ਤੋਂ ਬਾਅਦ ਹੂੰ ਹੂੰ ਹਾਂਜੀ ਹਾਂਜੀ ਓਕੇ ਓਕੇ

ਫਾਈਨ ਆਰਟਸ ਵਿੱਚ ਫਾਈਨ ਆਰਟਸ ਵਿੱਚ ਸਕੋਪ ਹੈਗਾ ਅੱਗੇ ਜਾ ਕੇ ਅੱਛਾ ਇਹ ਤਾਂ ਫਿਰ ਫੁੱਲ ਟਾਈਮ ਦੇਣਾ ਪੈਣਾ ਇਹਨੂੰ ਫਾਈਨ ਆਰਟਸ ਨੂੰ ਐੱਮ ਏ ਇੰਗਲਿਸ਼ ਵੱਲ ਜ਼ਿਆਦਾ ਸਹੀ ਗੱਲ ਹੈ ਕਿਉਂਕਿ ਇਹਦੇ ਨਾਲ ਟੀਚਿੰਗ ਜੋਬ ਵੀ ਮਿਲ ਸਕਦੀ ਹੈ ਆਪਾਂ ਨੂੰ ਅੱਗੇ ਜਾ ਕੇ ਤਾਂ ਕੋਈ ਨਾ ਕੋਈ ਹਾਂ ਇਹਦੇ ਨਾਲ ਬੀ ਐੱਡ ਵੀ ਹੋ ਜਾਏਗੀ ਅਤੇ ਐੱਮ ਏ ਬੀ ਐੱਡ ਹੋ ਜਾਏਗੀ ਅਤੇ ਅਤੇ ਅੱਛੀ ਜੋਬ ਵੀ ਮਿਲ ਸਕਦੀ ਹੈ ਐੱਮ ਐੱਡ ਵੀ ਕਰ ਸਕਦੇ ਹੈ ਹਾਂ ਪਰ ਨਾ ਟੀਚਿੰਗ ਲਾਈਨ ਵਾਲਾ ਜ਼ਿਆਦਾ ਸਕੋਪ ਔਰ ਟੀਚਿੰਗ ਲਾਈਨ ਤਾਂ ਵੈਸੇ ਵੀ ਗਰਲਜ਼ ਵਾਸਤੇ ਸਹੀ ਨੇ ਔਰ ਦੇਖਿਆ ਜਾਏ ਤਾਂ ਘਰ ਨੂੰ ਵੀ ਟਾਈਮ ਦੇ ਪਾਉਂਦੇ ਔਰ ਆਪਣਾ ਸਕੂਲ ਅਗਰ ਲੱਗੇ ਉੱਥੇ ਵੀ ਔਫਿਸ ਹਾਂ ਪ੍ਰੋਪਰ ਟਾਈਮ ਹੋ ਜਾਏਗਾ ਹਾਂ ਬਿਲਕੁਲ ਠੀਕ ਠੀਕ ਹੈ ਓਕੇ ਓ ਓਕੇ ਬਾਏ ਬਾਏ